ਤੇਰ੍ਹਾਂ ਫਰਵਰੀ ਦੋ ਹਜ਼ਾਰ ਚਾਰ ਸਤਾਰ੍ਹਾਂ ਜਨਵਰੀ ਦੋ ਹਜ਼ਾਰ ਤੇਰ੍ਹਾਂ ਸੱਤ ਅਗਸਤ ਦੋ ਹਜ਼ਾਰ ਦੋ ਪੰਜ ਦਸੰਬਰ ਦੋ ਹਜ਼ਾਰ ਬਾਈ ਸੱਤ ਮਾਰਚ ਦੋ ਹਜ਼ਾਰ ਛੇ